ਤਾਂ ਮੈਂ ਇਹ ਪੁੱਛਣਾ ਚਾਹੁੰਦਾ ਸੀ ਕਿ ਸਭ ਵਧੀਆ ਨੇ ਕਿਵੇਂ ਜੀ ਠੀਕ ਨੇ ਸਭ ਅਤੇ ਸੰਗੀਤ ਉਸਤਵ ਵਿੱਚ ਹਿੱਸਾ ਲੈਣ ਦਾ ਜੋ ਉਤਸ਼ਾਹ ਹੈ ਤੁਹਾਡੇ ਵਿੱਚ ਉਹ ਮੈਨੂੰ ਦਿੱਖ ਹੀ ਰਿਹਾ ਵਾ ਬਟ ਮੈਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਸੀ ਕਿ ਜੋ ਆਪਾਂ ਜਿਸ ਆਨਲਾਈਨ ਪਲੇਟਫਾਰਮ ਤੋਂ ਆਪਾਂ ਟਿਕਟ ਬੁੱਕ ਕਰਦੇ ਹੈ ਉਸ ਦੇ ਉੱਪਰ ਟਿਕਟ ਬੁੱਕ ਮੈਂ ਕਰ ਦਿੱਤੀ ਹੈ ਅਤੇ ਉਹਨੂੰ ਹਜੇ ਪੁਸ਼ਟੀ ਹੋਣ ਦੇ ਵਿੱਚ ਉਹਨੂੰ ਥੋੜ੍ਹਾ ਅਜੇ ਟਾਈਮ ਲੱਗੇਗਾ ਪਰ ਮੈਨੂੰ ਉਮੀਦ ਹੈ ਕਿ ਆਪਣੇ ਜੋ ਉਤਸਵ ਹੈ ਸੰਗੀਤ ਉਤਸਵ ਹੈ ਉਸ ਤੋਂ ਪਹਿਲਾਂ ਉਹ ਟਿਕਟ ਜੋ ਹੈ ਕਨਫਰਮ ਹੋ ਜਾਵੇਗੀ ਉਹਦੇ ਵਿੱਚ ਜਿੰਨ੍ਹੇ ਜਿੰਨ੍ਹੇ ਵੀ ਆਪਣਾ ਨਾਮ ਲਿਖਵਾਇਆ ਸੀਗਾ ਉਹਨਾਂ ਦਾ ਉਸਦੇ ਹਿਸਾਬ ਨਾਲ ਹੀ ਸੀਟ ਬੁੱਕ ਹੋਈ ਹੈ ਤਾਂ ਉਹਦੇ ਵਿੱਚ ਤੁਸੀਂ ਆਪਣੇ ਹਿਸਾਬ ਨਾਲ ਦੇਖ ਲਿਓ ਕਿ ਕਿਸ ਦੀ ਸੀਟ ਕਿਸ ਦਾ ਕੀ ਨੰਬਰ ਹੈ ਅਤੇ ਕਿਸ ਡੱਬੇ ਦੇ ਵਿੱਚ ਉਹ ਸੀਟ ਆਵੇਗੀ